ਸਾਡੇ ਇਲਾਕੇ ਦੇ ਬਹੁਤ ਸਾਰੇ ਪ੍ਰਸਿੱਧ ਸਕੂਲ ਹਨ ਜਿਵੇਂ ਕਿ ਸੀ ਆਰ ਜੀ ਕੇ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਐਮ ਆਰ ਸਿਟੀ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਬੀ ਪੀ ਐਸ ਸਕੂਲ ਅਤੇ ਹੋਰ ਵੀ ਬਹੁਤ ਸਾਰੇ ਸਕੂਲ ਹਨ ਅਤੇ ਇਹਨਾਂ ਅਤੇ ਇਹ ਸਾਰੇ ਸਕੂਲ ਬਹੁਤ ਵਧੀਆ ਹਨ ਅਤੇ ਇਹਨਾਂ ਦੀ ਸ ਇਹਨਾਂ ਵਿੱਚ ਸਿੱਖਿਆ ਵੀ ਬਹੁਤ ਵਧੀਆ ਢੰਗ ਨਾਲ ਦਿੱਤੀ ਜਾਂਦੀ ਹੈ ਪਰ ਇਹਨਾਂ ਸਾਰੇ ਸਕੂਲਾਂ ਦੀ ਫੀਸ ਬਹੁਤ ਜ਼ਿਆਦਾ ਏ ਜਿਹਦੇ ਕਰਕੇ ਜਿਹੜੇ ਗਰੀਬ ਜਿਹੜੇ ਗਰੀਬ ਹੈ ਉਹ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ ਅਤੇ ਪਰ ਇਹਦੇ ਨਾਲ ਨਾਲ ਜਿਹੜੇ ਸਰਕਾਰੀ ਸਕੂਲ ਹੈ ਹੁਣ ਉਹ ਵੀ ਬਹੁਤ ਵਧੀਆ ਬਣ ਚੁ ਬਣ ਚੁੱਕੇ ਹਨ ਕਿਉਂਕਿ ਉਹਨਾਂ ਵਿੱਚ ਸਰਕਾਰ ਨੇ ਸਮਾਰਟ ਕਲਾਸਿਸ ਦਿੱਤੀਆਂ ਹਨ ਜਿਹਦੇ ਨਾਲ ਬੱਚੇ ਜਲਦੀ ਸਿੱਖਦੇ ਹਨ ਸਮਾਰਟ ਕਲਾਸਿਸ ਦੇ ਥਰੂ ਅਤੇ ਨਾਲ ਨਾਲ ਲਾਈਬ੍ਰੇਰੀ ਵੀ ਪ੍ਰੋਵਾਈਡ ਕਰਵਾਈ ਹੈ ਅਤੇ ਉਹਦੇ ਨਾਲ ਨਾਲ ਜਿਹੜੀ ਸਾਈੰਸ ਦੀ ਲੈਬ ਅਲੱਗ ਅਲੱਗ ਤਰ੍ਹਾਂ ਦੀਆਂ ਲੈਬਸ ਦਿੱਤੀਆਂ ਏ ਜਿਹਦੇ ਵਿੱਚ ਜਿਹੜੇ ਐਕਸਪੈਰੀਮੈਂਟਸ ਨੂੰ ਬੱਚੇ ਪ੍ਰੈਕਟੀਕਲ ਕਰਦੇ ਹੈ ਅਤੇ ਉਹਦੇ ਨਾਲ ਉਹ ਜਲਦੀ ਸਿੱਖਦੇ ਹੈ ਅਤੇ ਜਿਹੜੇ ਸਰਕਾਰੀ ਸਕੂਲਾਂ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਸਿੱਖਿਆ ਹੋ ਗਈ ਹੈ ਹੁਣ ਪਹਿਲਾਂ ਦੇ ਨਾਲੋਂ ਕਿਉਂਕਿ ਬਹੁਤ ਸਾਰੇ ਚੇਂਜਸ ਆ ਗਏ ਸਰਕਾਰੀ ਸਕੂਲਾਂ 'ਚ ਵੀ ਇਸ ਲਈ ਹੁਣ ਵੱਡੇ ਸ਼ਹਿਰਾਂ ਦੇ ਸ ਦੇ ਸਕੂਲਾਂ ਨੂੰ ਤਰਜੀਹ ਦੇਣ ਨਾਲੋਂ ਜ਼ਿਆਦਾਤਰ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਕਿ ਜੋ ਜਦੋਂ ਜ਼ਿਆਦਾਤਰ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨਗੇ ਤਾਂ ਜਿਹੜੀ ਗਵਰਨਮੈਂਟ ਹੈ ਉਹ ਹੋਰ ਸਰਕਾਰੀ ਸਕੂਲਾਂ ਨੂੰ ਡਿਵੈਲਪ ਕਰੇਗੀ